ਸਤਿ ਸ਼੍ਰੀ ਅਕਾਲ ਜੀ ਪੰਜਾਬੀ ਆਪਣੀ ਭਾਸ਼ਾ ਸੱਭਿਆਚਾਰ ਪਰੰਪਰਾਵਾਂ ਨੂੰ ਮਨਾਉਣ ਲਈ ਸਨਮਾਨ ਦੇਣ ਲਈ ਆਪਣੀ ਵਰਤੋਂ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਹਨ ਪੰਜਾਬੀ ਪਹਿਰਾਵਾ ਪਹਿਨ ਕੇ ਪੰਜਾਬੀ ਬੋਲ ਕੇ ਪੰਜਾਬੀ ਪੰਜਾਬੀ ਬੋਲ ਕੇ ਪੰਜਾਬੀ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੇ ਰੀਤੀ ਰਿਵਾਜ਼ ਤੌਰ ਤਰੀਕੇ ਅਪਣਾ ਕੇ ਪੰਜਾਬੀ ਇਸ ਤਰ੍ਹਾਂ ਆਪਣੇ ਪੰਜਾਬੀ ਪਰੰਪਰਾਵਾਂ ਨੂੰ ਸਨਮਾਨ ਦਿੰਦੇ ਹਨ ਅਤੇ ਉਹ ਆਪਣੀ ਪੰਜਾਬੀ ਦੀ ਭਾਸ਼ਾ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ ਜਿੱਦਾਂ ਕਿ ਬੱਚਾ ਜਨਮ ਲੈਂਦਾ ਹੈ ਉਹਨੂੰ ਪੰਜਾਬੀ ਬੋਲਣੀ ਸਿਖਾਉਂਦੇ ਨੇ ਪੰਜਾਬੀ ਜਦੋਂ ਬੋਲਣੀ ਸਿਖਾਉਂਦੇ ਨੇ ਤਾਂ ਉਦੋਂ ਹੀ ਪੰਜਾਬੀ ਬੱਚਾ ਕਵਰ ਕਰਦਾ ਹੈ ਤਾਂ ਉਹਨੂੰ ਪੰਜਾਬੀ ਸਿਖਾਉਂਦੇ ਨੇ ਇਸ ਕਰਕੇ ਉਹ ਪੰਜਾਬੀ ਆਪਣੀ ਭਾਸ਼ਾ ਦੀ ਵਰਤੋਂ ਕਰਦੇ ਹਨ ਅਤੇ ਪੰਜਾ ਪੰਜਾਬੀ ਲੋਕ ਲੋਕ ਲੋਕ ਕਥਾ ਲੋਕ ਜਿਵੇਂ ਮੇਲੇ ਵਗੈਰਾ ਵਿੱਚ ਜਾ ਕੇ ਪੰਜਾਬੀ ਦਿਖਾਉਂਦਾ ਦ੍ਰਿਸ਼ ਦਿਖਾਉਂਦੇ ਨੇ ਸਮ ਸੱਭਿਆਚਾਰਕ ਪਰੰਪਰਾਵਾਂ ਦਿਖਾਉਂਦੇ ਨੇ ਜਿਵੇਂ ਪੰਜਾ ਪੰਜਾਬ ਦੀਆਂ ਪਰੰਪਰਾਵਾਂ ਹੁੰਦੀਆਂ ਹਨ ਉਹ ਦਿਖਾਉਂਦੇ ਨੇ